ਮੈਂ ਦਿਕਸ਼ਾ ਗੁਰਦਾਸਪੁਰ ਜਿਲੇ ਦੀ ਰਹਿਣ ਵਾਲੀ ਹਾਂ ਮੈਂ ਦੱਸਣਾ ਚਾਹੁੰਦੀ ਹਾਂ ਕੀ ਮੈਂ ਬਹੁਤ ਸਾਰੀਆਂ ਕਹਾਣੀਆਂ ਅਤੇ ਕਵਿਤਾਵਾਂ ਲਿਖਦੀ ਹਾਂ ਅਤੇ ਮੈਂ ਆਮ ਤੌਰ ਤੇ ਪੰਜਾਬੀ ਭਾਸ਼ਾ ਵਿੱਚ ਹੀ ਇਹ ਕਵਿਤਾਵਾਂ ਅਤੇ ਕਹਾਣੀਆਂ ਲਿਖਦੀ ਹਾਂ ਮੈਨੂੰ ਇਹ ਚੰਗਾ ਲੱਗਦਾ ਹੈ ਕਿ ਮੈਂ ਨਵੀਆਂ ਨਵੀਆਂ ਕਹਾਣੀਆਂ ਲਿਖਾਂ ਅਤੇ ਉਹਨਾਂ ਬਾਰੇ ਸੋਚਾਂ ਮੈਂ ਹਮੇਸ਼ਾ ਜਦੋਂ ਆਪਣੇ ਸਾਹਮਣੇ ਕੁਝ ਅਜਿਹੀਆਂ ਘਟਨਾਵਾਂ ਵੇਖਦੀ ਹਾਂ ਜਿਨਾਂ ਤੋਂ ਅਸੀਂ ਕੁਝ ਸਿੱਖ ਸਕਦੇ ਹਾਂ ਤਾਂ ਮੈਂ ਉਹਨਾਂ ਨੂੰ ਜਰੂਰ ਲਿਖਦੀ ਹਾਂ ਅਤੇ ਉਹਨਾਂ ਨੂੰ ਲਿਖਣ ਵੇਲੇ ਮੈਨੂੰ ਇੱਕ ਅਜਿਹੀ ਖੁਸ਼ੀ ਮਿਲਦੀ ਹੈ ਜੋ ਕਿ ਬਹੁਤ ਹੀ ਸ਼ੁਖਦ ਹੁੰਦੀ ਹੈ ਕਿਉਂਕਿ ਉਹਨਾਂ ਕਹਾਣੀਆਂ ਤੋਂ ਅਸੀਂ ਆਪਣੇ ਜੀਵਨ ਵਿੱਚ ਹਮੇਸ਼ਾ ਕੁਝ ਨਾ ਕੁਝ ਜਰੂਰ ਸਿੱਖਦੇ ਹਾਂ ਅਤੇ ਮੈਂ ਬਹੁਤ ਸਾਰੀਆਂ ਕਹਾਣੀਆਂ ਕਵਿਤਾਵਾਂ ਪੜ੍ਹੀਆਂ ਵੀ ਹਨ ਅਤੇ ਲਿਖੀਆਂ ਵੀ ਹਨ ਤੇ ਮੇਰਾ ਫੋਕਸ ਇਸ ਲਈ ਰਹਿੰਦਾ ਹੈ ਕਿਉਂਕਿ ਮੈਂ ਆਪਣੇ ਸਾਹਮਣੇ ਹੋਈਆ ਘਟਨਾਵਾਂ ਤੋਂ ਹਮੇਸ਼ਾ ਕੁਝ ਵੀ ਸਿੱਖਣ ਲਈ ਤਤਪਰ ਰਹਿੰਦੀ ਹਾਂ ਅਤੇ ਉਹਨਾਂ ਘਟਨਾਵਾਂ ਨੂੰ ਆਪਣੇ ਜੀਵਨ ਵਿੱਚ ਵੀ ਜਰੂਰ ਇਸਤੇਮਾਲ ਕਰਦੀ ਹਾਂ ਤਾਂ ਕੀ ਕਦੇ ਵੀ ਕੋਈ ਐਸਾ ਸਮਾਂ ਆਏ ਤਾਂ ਅਸੀਂ ਉਸ ਚੀਜ਼ ਨਾਲ ਜਰੂਰ ਲੜ ਸਕੀਏ ਧੰਨਵਾਦ